ਮੇਰਾ ਪਰਿਵਾਰ ਮੇਰੇ ਨਾਲ ਹਰ ਕਦਮ ਕਦਮ 'ਤੇ ਖੜਿਆ ਹੈ ਸਾਡੇ ਸਾਰੇ ਪਰਿਵਾਰ 'ਤੇ ਮੈਨੂੰ ਇੱਕ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਗਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਅਤੇ ਗਰੀਬ ਬੱਚਿਆਂ ਦੇ ਕੇਅਰ ਕਰਨ ਦਾ ਅਸੀਂ ਆਪਣੀ ਕਮਾਈ ਦਾ ਦਸਵਾਂ ਹਿੱਸਾ ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ ਉਹਦਾ ਦਸਵਾਂ ਹਿੱਸਾ ਕੱਢ ਕੇ ਗਰੀਬ ਬੱਚਿਆਂ ਦੀ ਪੜ੍ਹਾਈ ਜਾਂ ਗਰੀਬ ਕੋਈ ਬੱਚਾ ਜਿਹੜਾ ਇਲਾਜ ਨਹੀਂ ਕਰਾ ਸਕਦਾ ਉਹਦੇ ਇਲਾਜ ਲਈ ਅਸੀਂ ਦਸਵੰਧ ਦੀ ਵਰਤੋਂ ਕਰੀ ਦੀ ਹੈ ਜਿਹੜਾ ਬੱਚਾ ਨਹੀਂ ਪੜ੍ਹ ਸਕਦਾ ਉਹਨੂੰ ਪੜ੍ਹਾਈ ਦਾ ਹੈ ਸਾਡੇ ਸਾਰੇ ਪਰਿਵਾਰ ਸਾਡਾ ਇਸ ਕੰਮ ਦਾ ਇਸ ਕੰਮ ਵੀ ਬਹੁਤ ਸਾਥ ਦਿੰਦਾ ਹੈ ਮੈਨੂੰ ਆਪਣੇ ਪਰਿਵਾਰ 'ਤੇ ਮਾਨ ਹੈ ਅਸੀਂ ਸਭ ਗੁਰੂ ਸਾਹਿਬ ਦੀ ਦੱਸੀ ਰਾਹ ਉੱਤੇ ਚੱਲ ਰਹੇ ਹਾਂ ਸਾਡਾ ਮੇਰਾ ਪਰਿਵਾਰ ਹਰ ਕਦਮ ਕਦਮ 'ਤੇ ਬੋ ਕਿਸੇ ਗਰੀਬ ਦੀ ਮਦਦ ਕਰਨ ਲਈ ਮੇਰਾ ਸਾਥ ਦਿੰਦਾ ਰਹਿੰਦਾ ਹੈ